ਸਤਿ ਸ਼੍ਰੀ ਅਕਾਲ ਜੀ ਰਿਵਾਇਤੀ ਤੌਰ 'ਤੇ ਪੈੱਨ ਨਾਲ ਕਾਗਜ਼ 'ਤੇ ਲਿਖਣਾ ਬਹੁਤ ਪਸੰਦ ਕੀਤਾ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਸੁੰਦਰ ਲਿਖਾਈ ਦੇ ਮੁਕਾਬਲੇ ਹੁੰਦੇ ਸੀ ਅੱਖਰਾਂ ਦੀ ਵਧੀਆ ਵਧੀਆ ਬਨਾਵਟਾਂ ਬਣਾਈਆਂ ਜਾਂਦੀਆਂ ਸੀ ਪਰ ਸਮੇਂ ਦੇ ਬਦਲਣ ਦੇ ਨਾਲ ਨਾਲ ਇਹ ਜਿਹੜਾ ਵਾ ਪੈੱਨ ਦੇ ਨਾਲ ਕਾਗਜ਼ 'ਤੇ ਲਿਖਣਾ ਘਟਦਾ ਜਾ ਰਿਹਾ ਇਹ ਸਿਰਫ ਸਕੂਲਾਂ ਤੱਕ ਹੀ ਸੀਮਿਤ ਸਕੂਲਾਂ ਕਾਲਜਾਂ ਦਾ ਤੱਕ ਹੀ ਸੀਮਿਤ ਰਹਿ ਗਿਆ ਕਿਉਂਕਿ ਅਜੋਕੇ ਯੁੱਗ ਵਿੱਚ ਮੋਬਾਇਲ ਅਤੇ ਲੈਪਟੋਪ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਮੋਬਾਇਲ ਲੈਪਟੋਪ ਰਾਹੀਂ ਕੰਮ ਬਹੁਤ ਆਸਾਨ ਹੋ ਜਾਂਦੇ ਹਨ ਜ ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਅੱਜ ਕੱਲ੍ਹ ਚਿੱਠੀ ਦਾ ਯੁੱਗ ਹੀ ਖਤਮ ਹੋ ਚੁੱਕਾ ਹੈ ਜੋ ਵੀ ਮੈਸੇਜ ਭੇਜਣਾ ਹੈ ਜਾਂ ਕਿਸੇ ਨੂੰ ਭੇਜਣਾ ਹੈ ਉਹ ਅਸੀਂ ਘੱਟ ਹੀ ਸਮੇਂ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੱਕ ਵੀ ਆਪਣਾ ਮੈਸੇਜ ਭੇਜ ਸਕਦੇ ਹਾਂ ਇਸ ਕਰਕੇ ਜੋ ਲਿਖਾਈ ਵਿੱਚ ਵੀ ਫਰਕ ਪੈਂਦਾ ਜਾ ਰਿਹਾ ਹੈ ਅੱਗੇ ਲਿਖਾਈ ਦੀ ਸੁੰਦਰਤਾ ਬਹੁਤ ਜ਼ਿਆਦਾ ਸੀ ਪਰ ਅੱਜ ਕੱਲ੍ਹ ਇਹ ਚੀਜ਼ਾਂ ਆਉਣ ਨਾਲ ਹਰ ਕੰਮ ਆਸਾਨ ਹੋਣ ਨਾਲ ਲੋਕ ਜੋ ਹੈ ਕਿ ਖਾਸ ਤੌਰ 'ਤੇ ਮੋਬਾਇਲ ਅਤੇ ਲੈਪਟੋਪ 'ਤੇ ਹੀ ਆਪਣਾ ਸੁਨੇਹਾ ਲਿਖ ਕੇ ਭੇਜ ਦਿੰਦੇ ਹਨ ਅਤੇ ਇਸ ਨਾਲ ਜਿਹੜੀ ਲਿਖਣ ਦਾ ਪੈੱਨ ਨਾਲ ਕਾਗਜ਼ 'ਤੇ ਲਿਖਣ ਦਾ ਜਿਹੜਾ ਵਰਤੋਂ ਸੀ ਉਹ ਘੱਟਦੀ ਜਾ ਰਹੀ ਹੈ ਹੁਣ ਖਾਸ ਤੌਰ 'ਤੇ ਬੱਚੇ ਵੀ ਜੋ ਆ ਉਹ ਵੀ ਮੋਬਾਈਲ ਲੈਪਟੋਪ ਵਰਤਣਾ ਸ਼ੁਰੂ ਕਰ ਚੁੱਕੇ ਹਨ ਕਿਉਂਕਿ ਸਕੂਲਾਂ ਕਾਲਜਾਂ ਵਿੱਚ ਬਹੁਤ ਹੀ ਜ਼ਰੂਰੀ ਹੁੰਦਾ ਜਾ ਰਿਹਾ ਇਸ ਕਰਕੇ ਜਿਹੜੀ ਲਿਖਣ ਦੀ ਸ਼ਮਤਾ ਹੈ ਕਾਗਜ਼ਾਂ 'ਤੇ ਉਹ ਕਾਫੀ ਘਟਦੀ ਆ ਰਹੀ ਹੈ ਬੱਚਿਆਂ ਦੀ ਲਿਖਾਈ ਦਾ ਇਹ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਾ ਹੈ ਪਹਿਲਾਂ ਤਾਂ ਹਰ ਕੰਮ ਜੋ ਸਕੂਲਾਂ ਦਫਤਰ ਕਾਲਜਾਂ ਬੈਂਕਾਂ ਹਰ ਜਗ੍ਹਾ 'ਤੇ ਇਹ ਕਾਗਜ਼ ਪੈੱਨ ਹੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਆਹਾ ਹੁਣ ਦੇ ਸਮੇਂ ਵਿੱਚ ਇਹ ਸਾਰੇ ਹੀ ਜਗ੍ਹਾ 'ਤੇ ਕਾਗਜ਼ ਪੈੱਨ ਦੀ ਵਰਤੋਂ ਬਹੁਤ ਘੱਟ ਹੋ ਚੁੱਕੀ ਹੈ ਕਿਉਂਕਿ ਜਿੰਨੇ ਬੈਂਕ ਹੈ ਉਹ ਸਾਰੇ ਓ ਔਨਲਾਈਨ ਕੰਪਿਊਟਰ ਰਾਹੀਂ ਜੁੜ ਚੁੱਕੇ ਹਨ ਇਸ ਲਈ ਉੱਥੇ ਵੀ ਕੰਪਿਊਟਰਾਂ ਦੀ ਵਰਤੋਂ ਹੁੰਦੀ ਹੈ ਸਮੇਂ ਦੇ ਨਾਲ ਨਾਲ ਪੈੱਨ ਅਤੇ ਕਾਗਜ਼ ਦੀ ਵਰਤੋਂ ਦਾ ਬਹੁਤ ਘੱਟ ਗਈ ਹੈ ਅਤੇ ਬਹੁਤ ਹੀ ਫਰਕ ਪੈਂਦਾ ਜਾ ਰਿਹਾ ਸ਼ੁਕਰੀਆ